ਹੈਲੋ ਹਾਂਜੀ ਸਰ

ਸਰ ਉਹ ਜਦੋਂ ਤੁਸੀਂ ਇੰਟਰਵਿਊ ਦਿੱਤੀ ਹੋਊਗੀ ਤਾਂ ਤੁਹਾਨੂੰ ਉਦੋਂ ਉਹਨਾਂ ਨੇ ਸੈਲਰੀ ਵੀ ਦੱਸੀ ਹੋਊਗੀ ਜੀ ਸਰ ਵਿੱਚ ਤਾਂ ਬੈਠੇ ਸੀ ਪਰ ਟੀਮ ਨੇ ਮਿਲ ਕੇ ਡਿਸਾਈਡ ਕਰਨਾ ਹੁੰਦਾ ਨਾ ਵੀ ਕਿੰਨੀ ਪੇ ਦੇਣੀ ਹੁੰਦੀ ਆ ਤਾਂ ਜਿੰਨੀ ਸਾਡੇ ਕੋਲ ਆਈ ਓਨੀ ਫੇਰ ਅਸੀਂ ਤੁਹਾਨੂੰ ਪੇ ਕਰਨੀ ਆ ਸਰ ਮੈਂ ਇਹਦੇ ਵਿੱਚ ਕੁਛ ਨਹੀਂ ਕਰ ਸਕਦਾ ਕਿਉਂਕਿ ਇਹ ਮਿਲ ਕੇ ਟੀਮ ਨੇ ਪੇ ਬਣਾਈ ਹੁੰਦੀ ਆ ਅਤੇ ਜਿਵੇਂ ਮਤਲਬ ਟੀਮ ਨੂੰ ਹੁਕਮ ਹੁੰਦਾ ਵਾ ਉੱਦਾਂ ਹੀ ਕਰਦੇ ਆ ਸਰ ਮੈਂ ਇੱਕ ਵਾਰੀ ਉਹਨਾਂ ਨਾਲ ਗੱਲ ਕਰ ਲਵਾਂਗਾ ਤੁਹਾਡੇ ਕਹਿਣ 'ਤੇ ਅਤੇ ਬਾਕੀ ਤੁਸੀਂ ਆਫਿਸ ਆ ਸਕਦੇ ਹੋ ਤਾਂ ਜ਼ਰੂਰ ਉਹਨਾਂ ਨੂੰ ਮਿਲ ਕੇ ਆਪਣੇ ਆਪ ਜਾਓ ਸਰ ਫਿਰ ਇਹਦੇ ਵਿੱਚ ਸਰ ਉਹ ਤਾਂ ਉਹ ਤਾਂ ਤੁਸੀਂ ਸਰ ਫਿਰ ਉਹਨਾਂ ਨਾਲ ਗੱਲ ਕਰੋ ਨਾ ਮੈਨੂੰ ਤਾਂ ਜਿੰਨੀ ਉਹਨਾਂ ਨੇ ਕਿਹਾ ਵਾ ਮੈਂ ਤਾਂ ਤੁਹਾਨੂੰ ਓਨੀ ਕਰ ਸਕਦਾ ਕਿਉਂਕਿ ਵੱਧ ਤਾਂ ਮੈਂ ਕਰ ਨਹੀਂ ਸਕਦਾ ਸਰ ਸਲੈਕਟ ਤਾਂ ਕੀਤਾ ਸੀ ਅਸੀਂ ਕੋਈ ਫਰੋਡ ਨਹੀਂ ਕਰ ਰਹੇ ਜਿੰਨੀ ਸਾਨੂੰ ਉੱਪਰੋਂ ਆਰਡਰ ਆਏ ਆ ਵੀ ਇੰਨੀ ਪੇਮੈਂਟ ਦੇਣੀ ਆ ਅਸੀਂ ਓਨੀ ਪੇਮੈਂਟ ਹੀ ਦੇਵਾਂਗੇ ਸਰ ਸਾਡੇ ਵਿੱਚ ਇਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੈਗਾ ਗਾ ਸਰ ਇੰਮਪਲੋਏ ਰੱਖਣ ਵਾਸਤੇ ਹੀ ਤਾਂ ਅਸੀਂ ਪੋਸਟ ਕੱਢੀਆਂ ਸੀਗੀਆਂ ਹੁਣ ਇੰਮਪਲੋਏ ਅਸੀਂ ਰੱਖਾਂਗੇ ਹੀ ਤੁਹਾਨੂੰ ਤੁਹਾਨੂੰ ਅਸੀਂ ਸਲੈਕਟ ਕੀਤਾ ਹੋਇਆ ਅਤੇ ਅਸੀਂ ਰੱਖਾਂਗੇ ਪਰ ਪੇ ਅਸੀਂ ਹੁਣ ਜਿੰਨੀ ਹੈਗੀ ਉਸ ਤੋਂ ਵੱਧ ਤਾਂ ਨਹੀਂ ਅਸੀਂ ਕਰ ਸਕਦੇ ਜੀ ਕਿਉਂਕਿ ਉਹ ਤਾਂ ਤੁਹਾਨੂੰ ਫਿਰ ਗੱਲ ਕਰਨੀ ਪੈਣੀ ਓਕੇ ਸਰ ਥੈਂਕ ਯੂ